ਮੇਰੇ ਦੁਆਰਾ ਇਕੱਠੇ ਕੀਤੇ ਗਏ ਪਹਿਲਾਂ ਦੇ ਸਿੱਕੇ ਸਟੈਂਪ ਸਿੱਕੇ ਪੁਰਾਣੇ ਸਮੇਂ ਦੇ ਰਾਜਿਆਂ ਦੇ ਨਵਾਬਾਂ ਦੇ ਸਮੇਂ ਦੇ ਸ ਹਨ ਉਹਨਾਂ ਵਿੱਚ ਜ਼ਿਆਦਾਤਰ ਉਰਦੂ ਅਤੇ ਫਾਰਸੀ ਭਾਸ਼ਾ ਵਿੱਚ ਦੇ ਲਿਖਿਆ ਹੋਇਆ ਇਹ ਮੇਰੇ ਲਈ ਇੱਕ ਰਿਕੋਡ ਦੇ ਤੌਰ 'ਤੇ ਬਹੁਤ ਲਾਭਦਾਇਕ ਹੈ ਮੈਂ ਆਪਣੇ ਵਿਦਿਆਰਥੀਆਂ ਨੂੰ ਅਤੇ ਆਪਣੇ ਮਿਲਣ ਵਾਲਿਆਂ ਨੂੰ ਉਹਨਾਂ ਸਿੱਖਿਆ ਦੀ ਨੌਲੇਜ ਦੱਸਦਾ ਜਿਸ ਤੋਂ ਸਾਨੂੰ ਸਾਡੇ ਇਤਿਹਾਸ ਬਾਰੇ ਕਿ ਪਹਿਲਾਂ ਕਿਹੜੇ ਸਿੱਕੇ ਏ ਚਲਦੇ ਸੀ ਸਾਡੀ ਕਰੰਸੀ ਬਾਰੇ ਲੋਕਾਂ ਨੂੰ ਮੈਂ ਜਾਣੂ ਕਰਵਾ ਦਿੰਦਾ ਅਤੇ ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਇਸਦਾ ਬਹੁਤ ਫਾਇਦਾ ਹੁੰਦਾ ਹੈ ਇਸ ਤੋਂ